ਪੰਜਾਬ ਵਿੱਚ ਕਾਫ਼ੀ ਸਿੱਖਿਆ ਪ੍ਰਣਾਲੀ ਵਿਕਸਿਤ ਹੋਈ ਹੈ ਜਿਵੇਂ ਪੰਜਾਬ ਦੇ ਵਿੱਚ ਪਟਿਆਲੇ ਦੇ ਰਹਿ ਵਿੱਚ ਮੈਂ ਖੁਦ ਰਹਿਣ ਵਾਲੀ ਹਾਂ ਅਤੇ ਇੱਥੇ ਦਾ ਕੋਲੇਜ ਮਹਿੰਦਰਾ ਕੋਲੇਜ ਵਿੱਚ ਮੈਂ ਪੜ੍ਹਦੀ ਹਾਂ ਅਤੇ ਮਹਿੰਦਰਾ ਕੋਲੇਜ ਵਿੱਚ ਪਿਛਲੇ ਕੁਛ ਸਾਲਾਂ ਵਿੱਚ ਮੈਨੇ ਕਾਫ਼ੀ ਇਸਨੂੰ ਵਿਕਸਿਤ ਹੁੰਦੇ ਹੋਏ ਵੇਖਿਆ ਹੈ ਇਹ ਕੋਲੇਜ ਬਹੁਤ ਹੀ ਵਧੀਆ ਹੈ ਅਤੇ ਇੱਥੇ ਦੇ ਜਿੰਨੇ ਵੀ ਅਧਿਆਪਕ ਹਨ ਬਹੁਤ ਹੀ ਪੜ੍ਹੇ ਲਿਖੇ ਹਨ ਅਤੇ ਉਹਨਾਂ ਨੇ ਪੀ ਐੱਚ ਡੀ ਅਤੇ ਬਹੁਤ ਹੀ ਹਾਈ ਕੁਆਲੀਫਿਕੇਸ਼ਨ ਦੇ ਹਨ ਉਹ ਸਾਨੂੰ ਹਰ ਵੇਲੇ ਹਰ ਸਿੱਖਿਆ ਦਿੰਦੇ ਹਨ ਅਤੇ ਸ ਪੜ੍ਹਾਈ ਤੋਂ ਇਲਾਵਾ ਸਾਨੂੰ ਜੀਵਨ ਬਾਰੇ ਜਾਂ ਕਿਸੀ ਹੋਰ ਚੀਜ਼ ਬਾਰੇ ਸਾਨੂੰ ਪ੍ਰੋਤਸਾਹਿਤ ਕਰਦੇ ਹਨ ਅਤੇ ਉਹਨਾਂ ਬਾਰੇ ਸਾਨੂੰ ਸਿੱਖਿਆ ਦਿੰਦੇ ਹਨ ਅਤੇ ਇੱਧਰ ਦੇ ਕੋਲੇਜ ਹੋਰ ਹਨ ਜਿਵੇਂ ਮੋਦੀ ਕੋਲੇਜ ਹੋ ਗਿਆ ਪੰਜਾਬੀ ਯੂਨੀਵਰਸਿਟੀ ਖਾਲਸਾ ਕੋਲੇਜ ਅਤੇ ਥਾਪਰ ਯੂਨੀਵਰਸਿਟੀ ਹੈ ਜੋ ਕਿ ਬਹੁਤ ਹੀ ਵਧੀਆ ਹੈ ਅਤੇ ਉਹਨਾਂ ਵਿੱਚ ਵੀ ਸਿੱਖਿਆ ਪ੍ਰਣਾਲੀ ਬਹੁਤ ਹੀ ਵਧੀਆ ਹੈ ਅਤੇ ਇੱਥੇ ਦੇ ਅਧਿਆਪਕ ਜਿੰਨੇ ਹਨ ਪਰ ਪੰਜਾਬ ਦੇ ਬਹੁਤ ਹੀ ਵਧੀਆ ਅਤੇ ਸਿੱਖਿਅਕ ਹਨ ਅਤੇ ਪੀ ਐੱਚ ਡੀ ਵਗੈਰਾ ਆਦਿ ਉਹਨਾਂ ਨੇ ਆਪਣੇ ਕੀਤੀ ਹੈ ਅਤੇ ਉਹੀ ਸਾਨੂੰ ਜੋ ਸਿੱਖਿਆ ਉਹਨਾਂ ਨੇ ਪ੍ਰਾਪਤ ਕੀਤੀ ਹੈ ਉਹੀ ਸਿੱਖਿਆ ਸਾਨੂੰ ਦਿੰਦੇ ਹਨ ਸਾਨੂੰ ਹਰ ਆਪਣੇ ਸੱਭਿਆ ਪੰਜਾਬੀ ਸੱਭਿਆਚਾਰ ਬਾਰੇ ਹੁਣ ਸਿੱਖਿਆ ਦਿੰਦੇ ਹਨ ਸਿੱਖਿਆ ਪ੍ਰਣਾਲੀ ਦੇ ਵਿੱਚ ਜੋ ਜੋ ਵਿਚਰਨਾ ਹੈ ਅਤੇ ਕਿਵੇਂ ਸਾਨੂੰ ਅੱਗੇ ਆਪਣੇ ਕੰਮ ਕਾਰ ਕਰਨੇ ਹਨ ਜਾਂ ਫਿਰ ਸਾਨੂੰ ਸੱ ਸੱਭਿਆਚਾਰ ਵਿੱਚ ਕਿਵੇਂ ਵਿਚਰਨਾ ਹੈ ਉਸਦੀ ਸਿੱਖਿਆ ਦਿੰਦੇ ਹਨ ਜਿਸ ਕਾਰਨ ਪੰਜਾਬ ਵਿੱਚ ਜਿੰਨੇ ਵੀ ਸਿੱਖਿਆ ਪ੍ਰਣਾਲੀ ਹਨ ਬਹੁਤ ਹੀ ਵਧੀਆ ਅਤੇ ਵਿਕਸਿਤ ਹੋਈ ਹੈ